ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ ਮੈਂ ਤੁਹਾਡੇ ਗੁਆਂਢ ਅਸੀਂ ਨਵੇਂ ਨਵੇਂ ਆਏ ਜੇ ਤਾਂ ਤੁਹਾਨੂੰ ਵੀ ਜੇ ਇੱਥੇ ਹੈਗੇ ਕੋਈ ਵੀ ਹਿਸਾਬ ਕਿਤਾਬ ਪਤਾ ਤੁਹਾਡੇ ਹਾਂ ਤਾਂ ਭੈਣ ਜੀ ਸਾਨੂੰ ਕੋਈ ਚੰਗੀ ਜਿਹੀ ਦੁਕਾਨ ਦੱਸਿਓ ਦੁੱਧ ਦੱਧ ਦਹੀਂ ਦੁਹੀਂ ਅਕਸਰ ਬੱਚਿਆਂ ਦੀਆਂ ਚੀਜ਼ਾਂ ਲੈਣੀਆਂ ਜਿਹੜਾ ਕੋਈ ਚੰਗਾ ਬੰਦਾ ਦੱਸਿਓ ਅਤੇ ਭੈਣ ਜੀ ਆਹੋ ਅੱਛਾ ਠੀਕ ਦੱਸਿਓ ਅੱਛਾ ਤੇ ਠੀਕ ਰੇਟ ਰੁਟ ਲਾਉਂਦੇ ਤੇ ਜਾਂ ਹਾਂ ਚਲੋ ਕੁਆਲਟੀ ਵਧੀਆ ਹੋਣੀ ਚਾਹੀਦੀ ਹੈ ਦੁੱਧ ਚੱਜ ਦਾ ਹੀ ਹੋਏ ਤਾਂ ਫੇਰ ਹੀ ਹੈ ਨਾ ਭੈਣ ਗੱਲ ਨਹੀਂ ਜਿੱਥੋਂ ਤੁਸੀਂ ਲੈਂਦੇ ਹੋ ਇਹ ਉਹ ਥੋੜ੍ਹਾ ਹੁਣ ਸਾਨੂੰ ਅਸੀਂ ਓਪਰੇ ਹੈਂਗੇ ਅਤੇ ਸਾਨੂੰ ਤੁਸੀਂ ਹੋਰ ਕਿਤੇ ਫਸਾ ਦੇਵੋ ਇਹ ਗੱਲ ਨਹੀਂ ਤੁਸੀਂ ਜਿੱਥੇ ਚ ਠੀਕ ਹੈ ਅੱਛਾ ਅੱਛਾ ਸਰਪੰਚ ਦੀ ਰੇਹੜੀ ਡੇਅਰੀ ਕਹਿੰਦੇ ਲੋਕ ਚੱਲ ਠੀਕ ਹੈ ਭੈਣ ਉੱਥੇ ਉੱਥੇ ਤਾਂ ਮੈਂ ਪਹੁੰਚ ਜਾਉਂ ਸਰਪੰਚ ਕੋਈ ਗੱਲ ਨਹੀਂ ਪਹੁੰਚ ਜਾਵਾਂਗੀ ਉੱਥੇ ਸਰਪੰਚ ਦੀ ਡੇਅਰੀ ਅੱਛਾ ਹੋਰ ਸੁਣਾਓ ਭੈਣ ਕੁਛ